ਮੇਰੀ ਇੱਕ ਵੱਡੀ ਭੈਣ ਹੈ ਜੋ ਕਿ ਮੇਰੇ ਤੋਂ ਇੱਕ ਸਾਲ ਵੱਡੀ ਹੈ ਪਰ ਸਾਡੇ ਵਿੱਚ ਬਹੁਤ ਹੀ ਜ਼ਿਆਦਾ ਸਮਾਨਤਾ ਹੈ ਕਿਉਂਕਿ ਉਸ ਨੂੰ ਕਿਤਾਬਾਂ ਵਿੱਚ ਬਹੁਤ ਹੀ ਜ਼ਿਆਦਾ ਰੁਚੀ ਹੈ ਅਤੇ ਮੈਨੂੰ ਬਾਹਰ ਖੇਡਾਂ ਖੇਡਣ ਦੇ ਵਿੱਚ ਪਰ ਅਸੀਂ ਬਚਪਨ ਦੇ ਵਿੱਚ ਇਕੱਠੇ ਹੀ ਖੇਡਦੇ ਰਹੇ ਹਾਂ ਅਤੇ ਉਹ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਅਤੇ ਹਰ ਗਲਤੀ ਦੇ ਵਿੱਚ ਮੈਨੂੰ ਸਮਝਾਉਂਦੀ ਹੈ ਅਤੇ ਅਸੀਂ ਇੱਕ ਦੂਸਰੇ ਤੋਂ ਬਹੁਤ ਹੀ ਜ਼ਿਆਦਾ ਵੱਖਰੇ ਹਾਂ ਕਿਉਂਕਿ ਉਹ ਬਾਹਰ ਗੇਮਾਂ ਵਿੱਚ ਬਹੁਤ ਹੀ ਜ਼ਿਆਦਾ ਘੱਟ ਰੁਚੀ ਰੱਖਦੀ ਹੈ ਅਤੇ ਮੈਨੂੰ ਵੀ ਕਿਤਾਬਾਂ ਪੜ੍ਹਨ ਦੇ ਵਿੱਚ ਵਧੀਆ ਨਹੀਂ ਲੱਗਦਾ ਜਿਸ ਕਰਕੇ ਸਾਡੇ ਵਿੱਚ ਬਹੁਤ ਜ਼ਿਆਦਾ ਸਮਾਨਤਾ ਹੈ